ਹਾਂਜੀ ਟੀ ਵੀ ਸ਼ੋਅ ਸ਼ਾਰਕ ਟੈਂਕ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅੱਜ ਦੇ ਯੂਥ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੇਮਸ ਹੈ ਲੋਕ ਇਹਦੇ ਤੋਂ ਆਪਣੇ ਕਾਰੋਬਾਰ ਸ਼ੁਰੂ ਕਰਨ ਵਾਲੇ ਵੀ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਕੁਛ ਲੋਕ ਤਾਂ ਆਪਣੇ ਬੜੇ ਆਈਡੀਆ ਜਿਹੜੇ ਹੁੰਦੇ ਨੇ ਗਰਾਊਂਡ ਲੈਵਲ ਦੇ ਹੁੰਦੇ ਨੇ ਅਤੇ ਪਰ ਉਹਨੂੰ ਦਿਖਾਇਆ ਬੜੇ ਵਧੀਆ ਤਰੀਕੇ ਨਾਲ ਜਾਂਦਾ ਹੈ ਜਿਹਦੇ ਕਰਕੇ ਹਰ ਕੋਈ ਸੋਚਦਾ ਹੈ ਕਿ ਅਸੀਂ ਵੀ ਕਾਰੋਬਾਰ ਕਰ ਸਕਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਕਿਵੇਂ ਵੱਡਾ ਵੱਡਾ ਕਾਰੋਬਾਰ ਬਣ ਸਕਦਾ ਹੈ ਅਤੇ ਪ੍ਰਭਾਵਸ਼ਾਲੀ ਇਸ ਕਰਕੇ ਵੀ ਹੈਗਾ ਕਿਉਂਕਿ ਇੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਿਜ਼ਨਸ ਲਈ ਉਹਨਾਂ ਨੂੰ ਇਹ ਨਹੀਂ ਕਿ ਵੀ ਆਪਣਾ ਹੀ ਪੈਸਾ ਚਾਹੀਦਾ ਕਈ ਲੋਕ ਇਸ ਕਰਕੇ ਵੀ ਬੈਠ ਜਾਂਦੇ ਨੇ ਵੀ ਹਾਂ ਵੀ ਪੈਸ ਬਿਜ਼ਨਸ ਕਰਨ ਲਈ ਸਾਨੂੰ ਪੈਸਾ ਚਾਹੀਦਾ ਅਤੇ ਸਾਡੇ ਕੋਲ ਤਾਂ ਹੈ ਨਹੀਂ ਪਰ ਉਹ ਸ਼ਾਰਕ ਟੈਂਕ ਇੱਕ ਜ਼ਰੀਆ ਜਿਨ੍ਹਾਂ ਨੂੰ ਪਤਾ ਲੱਗਿਆ ਲੋਕਾਂ ਨੂੰ ਇੰਜਲ ਇਨਵੈਸਟਰ ਜਾਂ ਫੇਰ ਜਿਹੜੀ ਫੰਡਿੰਗ ਹੁੰਦੀ ਆ ਸੀਡ ਫੰਡਿੰਗ ਉਹ ਕੀ ਹੁੰਦੀ ਹੈ ਵੀ ਤੁਹਾਨੂੰ ਪੈਸਾ ਤੁਹਾਡੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਨ ਲਈ ਤੁਹਾਨੂੰ ਬ ਅ ਹੋਰ ਲੋਕਾਂ ਤੋਂ ਮਿਲ ਸਕਦਾ ਹੈ ਅਤੇ ਤੁਸੀਂ ਸਿਰਫ ਆਪਣਾ ਆਈਡੀਆ ਤੁਹਾਡੇ ਕੋਲ ਹੋਣਾ ਚਾਹੀਦਾ ਵਧੀਆ ਠੀਕ ਹੈ ਅਤੇ ਉਹਨੂੰ ਤੁਹਾਨੂੰ ਲਾਗੂ ਕਰਨਾ ਆਉਣਾ ਚਾਹੀਦਾ ਠੀਕ ਹੈ ਅਤੇ ਤੁਹਾਨੂੰ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਇਹ ਸ਼ਾਰਕ ਟੈਂਕ ਜਿਹੜਾ ਸ਼ੋਅ ਹੈ ਲੋਕਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਵੀ ਕਰਦਾ ਅਤੇ ਪ੍ਰਭਾਵਸ਼ਾਲੀ ਵੀ ਹੈ ਉਹਨਾਂ ਦੇ ਲਈ